ਸਤਿ ਸ਼੍ਰੀ ਅਕਾਲ ਜੀ ਭਾਰਤ ਵਿੱਚ ਉਸ ਤਰ੍ਹਾਂ ਦਾ ਬਹੁਤ ਖੇਡਾਂ ਹਨ ਪਰ ਕੁਝ ਪ੍ਰਸਿੱਧ ਖੇਡਾਂ ਹਾਕੀ ਫੁੱਟਬਾਲ ਗਤਕਾ ਕਿਰਕੇਟ ਚਿੜੀ ਛਿੱਕਾ ਵਾਲੀਬਾਲ ਬਾਸਕਿਟਬਾਲ ਅਤੇ ਹੋਰ ਵੀ ਕਈ ਖੇਡਾਂ ਹਨ ਇਹ ਖੇਡਾਂ ਬਹੁਤ ਵਧੀਆ ਹੁੰਦੀਆਂ ਹਨ ਸਾਨੂੰ ਖੇਡਾਂ ਵਿੱਚ ਕਈ ਪ੍ਰਕਾਰ ਦੇ ਗੁਣ ਪ੍ਰਾਪਤ ਹੁੰਦੇ ਹਨ ਸਾਨੂੰ ਖੇਡਾਂ ਖੇਡ ਕੇ ਇੱਕ ਜੁਟ ਰਹਿਣਾ ਆਉਂਦਾ ਹੈ ਸਾਨੂੰ ਰਲ ਕੇ ਕੰਮ ਕਰਨਾ ਸਿਖਾਇਆ ਜਾਂਦਾ ਹੈ ਖੇਡਾਂ ਖੇਡਣ ਨਾਲ ਅਸੀਂ ਤੰਦਰੁਸਤ ਰਹਿੰਦੇ ਹਾਂ ਸਾਡਾ ਮਾਨਸਿਕ ਅਤੇ ਸਰੀਰਕ ਵਿਕਾਸ ਹੁੰਦਾ ਹੈ ਸਾਡੇ ਸਾਰੇ ਸਰੀਰ ਵਿੱਚ ਮੋਟਾਪਾ ਨਹੀਂ ਆਉਂਦਾ ਖੇਡਾਂ ਖੇਡਣ ਨਾਲ ਅਸੀਂ ਸਾਰਾ ਦਿਨ ਖਿੜੇ ਮੱਥੇ ਰਹਿੰਦੇ ਹਾਂ ਸਾਨੂੰ ਗੁੱਸਾ ਘੱਟ ਆਉਂਦਾ ਹੈ ਸਾਡੇ ਸਾਰੇ ਸਰੀਰ ਲਈ ਖੇਡਾਂ ਖੇਡਣ ਬਹੁਤ ਜ਼ਿਆਦਾ ਜ਼ਰੂਰੀ ਹਨ ਸਾਨੂੰ ਇਹ ਇੱਕ ਟੀਮ 'ਚ ਰਹਿਣਾ ਸਿਖਾਉਂਦੀਆਂ ਹਨ ਇਸ ਵਿੱਚ ਰਹਿ ਕੇ ਅਸੀਂ ਵੱਖ ਵੱਖ ਪ੍ਰਭਾਤਾਂ ਦੇ ਲੋਕਾਂ ਨਾਲ ਮਿਲਦੇ ਹਾਂ ਅਤੇ ਸਾਡਾ ਸਾਰਾ ਤਜ਼ਰਬਾ ਉਹਨਾਂ ਨਾਲ ਮਿਲ ਕੇ ਹੋਰ ਚੰਗਾ ਬਣਦਾ ਹੈ ਅਤੇ ਲੋਕ ਆਪਣੇ ਲੀਡਰ ਨੂੰ ਸੁਣ ਕੇ ਅਤੇ ਸਾਡੇ ਉਹਨਾਂ ਦੀ ਗੱਲ ਮੰਨਦੇ ਹਨ ਇਸ ਨਾਲ ਸਾਡੇ ਵਿੱਚ ਵੀ ਲੀਡਰਸ਼ਿਪ ਅਤੇ ਕੁਆਲਿਟੀ ਆਉਂਦੀ ਹੈ ਅਤੇ ਸਾਡੇ ਦੇਸ਼ ਦੇ ਸਭ ਤੋਂ ਮਸ਼ਹੂਰ ਅਥਲੀਟ ਨੀਰਜ ਚੋਪੜਾ ਹਨ ਧੰਨਵਾਦ ਜੀ